ਪੰਜਾਬ ਵਿੱਚ ਜੋ ਸਰਕਾਰੀ ਗੈਰ ਸਰਕਾਰੀ ਸਕੂਲ ਅਤੇ ਕੋਲਜਿਜ ਨੇ ਉਹਦੇ ਵਿੱਚ ਮਤਲਬ ਸਿੱਖਿਆ ਦੇ ਸਮਾਨ ਮੌਕਿਆਂ ਲਈ ਰਾਖਵਾਂਕਰਨ ਰੱਖਿਆ ਜਾਂਦਾ ਅਲੱਗ ਅਲੱਗ ਸੀਟਾਂ ਦਿੱਤੀਆਂ ਜਾਂਦੀਆਂ ਹਨ ਐਸ ਸੀ ਬੀ ਸੀ ਹੈ ਨਾ ਅਨੁਸੂਚਿਤ ਜਾਤੀਆਂ ਹੋ ਗਈਆਂ ਅਨੁਸੂਚਿਤ ਕਬੀਲੇ ਹੋ ਗਏ ਹੋਰ ਪਛੜੀਆਂ ਸ਼੍ਰੇਣੀਆਂ ਹੋ ਗਈਆਂ ਉਹਨਾਂ ਦੇ ਜੋ ਬੱਚਿਆਂ ਨੂੰ ਮਤਲਬ ਸੀਟਾਂ ਦਿੱਤੀਆਂ ਜਾਂਦੀਆਂ ਹਨ ਕਿ ਉਹਨਾਂ ਨੂੰ ਸਿੱਖਿਆ ਦਾ ਸਮਾਨ ਮੌਕਾ ਮਿਲੇ ਕਈ ਵਾਰ ਹੁੰਦਾ ਕਿ ਨਾ ਕਿਸੇ ਦੇ ਘਰ ਓਨਾ ਉਸ ਤਰ੍ਹਾਂ ਆਰਥਿਕ ਤੌਰ 'ਤੇ ਉਹ ਮਤਲਬ ਨਹੀਂ ਹੁੰਦੇ ਓਨੇ ਮਜ਼ਬੂਤ ਕਿ ਉਹ ਆਪਣੇ ਬੱਚੇ ਨੂੰ ਇੰਨਾ ਪੜ੍ਹਾ ਸਕਣ ਨਾ ਓਨੇ ਨੇ ਉਹਨਾਂ ਦੀਆਂ ਫੀਸਾਂ ਦੇ ਸਕਣ ਇਸ ਲਈ ਇਹ ਸੀਟਾਂ ਦਾ ਪ੍ਰਬੰਧ ਕੀਤਾ ਗਿਆ ਕਿ ਅਲੱਗ ਅਲੱਗ ਸ਼੍ਰੇਣੀਆਂ ਨੂੰ ਉਹਨਾਂ ਦੇ ਮਤਲਬ ਜੋ ਜਾਇਦਾਦ ਆ ਉਸ ਦੇ ਹਿਸਾਬ ਨਾਲ ਮਤਲਬ ਹੁੰਦਾ ਕਿ ਐਸ ਸੀ ਬੀ ਸੀ ਕੈਟਾਗਰੀ ਦੇ ਹਿਸਾਬ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਅਤੇ ਕਾਲਜਾਂ ਵਿੱਚ ਸੀਟਾਂ ਦਿੱਤੀਆਂ ਜਾਂਦੀਆਂ ਹਨ ਨਾਲ ਹੀ ਉਹਨਾਂ ਦੇ ਵਜ਼ੀਫੇ ਦਾ ਪ੍ਰਬੰਧ ਕੀਤਾ ਜਾਂਦਾ ਜੇ ਜਿਵੇਂ ਐਸ ਸੀ ਬੀ ਸੀ ਕੈਟਾਗਰੀ ਜਰਨਲ ਕੈਟਾਗਰੀ ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਵਜ਼ੀਫੇ ਦਿੱਤੇ ਜਾਂਦੇ ਹਨ ਕਿ ਉਹਨਾਂ ਨੂੰ ਪੜ੍ਹਾਈ ਵਿੱਚ ਕੋਈ ਦਿੱਕਤ ਨਾ ਆਵੇ ਉਹਨਾਂ ਦੀਆਂ ਫੀਸਾਂ ਭਰੀਆਂ ਜਾਂਦੀਆਂ ਹਨ ਉਹਨਾਂ ਦੀ ਟਿਊਸ਼ਨ ਫੀਸ ਭਰੀ ਜਾਂਦੀ ਆ